ਸਾਡੇ ਪਿੰਡ ਵਿੱਚ ਅੰਤਿਮ ਸੰਸਕਾਰ ਸਮੇਂ ਬਹੁਤ ਰਸਮਾਂ ਕੀਤੀਆਂ ਜਾਂਦੀਆਂ ਹਨ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਸਸਕਾਰ ਵਾਸਤੇ ਲਿਜਾਣ ਸਮੇਂ ਸਭ ਤੋਂ ਪਹਿਲਾਂ ਸਾਫ ਪਾਣੀ ਨਾਲ ਨਹਾਇਆ ਜਾਂਦਾ ਨਹਾਉਣ ਤੋਂ ਬਾਅਦ ਉਸਨੂੰ ਸਾਫ ਸੁਥਰੇ ਕੱਪੜੇ ਪਾ ਕੇ ਫੱਟੇ ਦੇ ਉੱਪਰ ਲੈ ਕੇ ਸਿਵਿਆਂ ਵੱਲ ਲੈ ਕੇ ਜਾਇਆ ਜਾਂਦਾ ਹੈ ਥੋੜ੍ਹਾ ਸਮਾਂ ਜੇ ਥੋੜ੍ਹਾ ਪੰਧ ਬੀਬੀਆਂ ਜਾਂ ਭੈਣਾਂ ਨਾਲ ਜਾਂਦੀਆਂ ਨੇ ਉਹ ਅੱਗੇ ਜਾ ਕੇ ਮ੍ਰਿਤਕ ਸਰੀਰ ਨੂੰ ਥਾਂ 'ਤੇ ਰੱਖਿਆ ਜਾਂਦਾ ਅਤੇ ਇੱਕ ਘੜੇ ਦੇ ਵਿੱਚ ਪਾਣੀ ਪਾ ਕੇ ਵੱਡਾ ਪੁੱਤ ਉਹ ਸਰੀਰ ਦੇ ਸਾਰੇ ਪਾਸੇ ਗੇੜਾ ਕੱਢਦਾ ਅਤੇ ਘੜਾ ਤੋੜ ਦਿੰਦਾ ਹੈ ਘੜਾ ਟੁੱਟਣ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਚਾਰ ਬੰਦੇ ਮੋਢੇ 'ਤੇ ਚੁੱਕ ਕੇ ਸਿਵਿਆਂ ਵੱਲ ਲੈ ਜਾਂਦੇ ਨੇ ਅਤੇ ਬੀਬੀਆਂ ਜਾਂ ਤਾਂ ਉੱਥੇ ਬੈਠ ਜਾਂਦੀਆਂ ਨੇ ਜਾਂ ਉੱਥੇ ਕੁਝ ਸਮਾਂ ਬੈਠਣ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਚਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਸਿਵਿਆਂ ਵਿੱਚ ਲਿਜਾ ਕੇ ਲੱਕੜਾਂ ਚਿਣ ਦਿੱਤੀਆਂ ਜਾਂਦੀਆਂ ਨੇ ਅਤੇ ਗੁਰਦੁਆਰੇ ਗ੍ਰੰਥੀ ਸਿੰਘ ਤੋਂ ਅੰਤਿਮ ਅਰਦਾਸ ਕਰਵਾਈ ਜਾਂਦੀ ਹੈ ਅੰਤਿਮ ਅਰਦਾਸ ਹੋਣ ਤੋਂ ਬਾਅਦ ਵੱਡਾ ਪੁੱਤ ਜਾਂ ਕੋਈ ਘਰ ਦਾ ਵੱਡਾ ਬੰਦਾ ਸਰੀਰ ਨੂੰ ਅਗਨ ਭੇਟ ਕਰਦਾ ਅਗਨ ਭੇਟ ਹੋਣ ਤੋਂ ਬਾਅਦ ਦੁਬਾਰਾ ਫਿਰ ਸੁਖਮ ਅਰਦਾਸ ਕੀਤੀ ਜਾਂਦੀ ਹੈ ਅਤੇ ਅਲਾਣੀਆਂ ਦਾ ਪਾਠ ਕੀਤਾ ਜਾਂਦਾ ਅਲਾਣੀਆ ਪਾਠ ਖਤਮ ਹੋਣ ਤੋਂ ਬਾਅਦ ਉੱਥੇ ਦੱਸਿਆ ਜਾਂਦਾ ਹੈ ਕਿ ਅਸਤ ਸਤਾਰੀਆ ਜਾਂ ਚੌਥਾ ਕਿਸ ਦਿਨ ਹੋਏਗਾ ਜਿਹਨੂੰ ਅਸੀਂ ਆਪਣੀ ਭਾਸ਼ਾ ਵਿੱਚ ਫੁੱਲ ਵੀ ਕਹਿ ਦਿੰਦੇ ਹਾਂ ਜੀ ਧੰਨਵਾਦ